ਖੇਤੀਬਾੜੀ ਅਤੇ ਭੋਜਨ ਵਿੱਚ ਸਟੈਮ ਦੀ ਬਹੁਤ ਵੱਡੀ ਭੂਮਿਕਾ ਹੈਗੀ ਆ ਜਿਸ ਤਰ੍ਹਾਂ ਖੇਤੀਬਾੜੀ ਹੈ ਉਹ 'ਚ ਰੋਜ਼ ਨਵੇਂ ਨਵੇਂ ਤਰ੍ਹਾਂ ਦੇ ਉਪਕਰਨ ਆ ਰਹੇ ਐਂ ਪਹਿਲਾਂ ਲੋਕ ਖੇਤੀਬਾੜੀ ਹੋਰ ਤਰੀਕੇ ਨਾਲ਼ ਕਰਦੇ ਹਨ ਬਹੁਤ ਟਾਈਮ ਲੱਗਦਾ ਸੀਗਾ ਅਤੇ ਅੱਜ ਕੱਲ੍ਹ ਬਹੁਤ ਨਵੀਆਂ ਮਸ਼ੀਨਾਂ ਆ ਗਈਆਂ ਹਨ ਅਤੇ ਕੋਈ ਬੀਜ ਬੀਜਣਾ ਹੋਵੇ ਜਾਂ ਨਵਾਂ ਕੋਈ ਬੀਜ ਲੈਣਾ ਹੋਵੇ ਤਾਂ ਉਹਦੀ ਲੋਕ ਵਰਤੋਂ ਕਰਦੇ ਆ ਉਸੇ ਤਰ੍ਹਾਂ ਜਿਹੜਾ ਭੋਜਨ ਉਦਯੋਗ ਹੈਗਾ ਉਹਦੇ ਬਹੁਤ ਸਾਰੇ ਨਵੇਂ ਤਰੀਕੇ ਆ ਗਏ ਆ ਉਹਦੇ ਵਿੱਚ ਇਲੈਕਟ੍ਰੀਕਲ ਕੁੱਕਰ ਵੀ ਆ ਗਿਆ ਓ ਟੀ ਜੀ ਆ ਗਏ ਹੈਗੇ ਮਾਈਕ੍ਰੋਵੇਵ ਆ ਗਏ ਹੈਗੇ ਆ ਇੰਡਕਸ਼ਨ ਵਾਲੇ ਕੁੱਕਰ ਆ ਗਏ ਹੈਗੇ ਤਾਂ ਇਹਨਾਂ ਨਾਲ਼ ਜਿਹੜਾ ਭੋਜਨ ਵੀ ਛੇਤੀ ਪੱਕਦਾ ਹੈਗਾ ਪੋਸ਼ਟਿਕਤਾ ਵੀ ਰਹਿੰਦੀ ਉਹਨਾਂ ਵਿੱਚ ਅਤੇ ਲੋਕ ਬਹੁਤ ਜ਼ਿਆਦਾ ਇਹਨਾਂ ਨੂੰ ਯੂਜ਼ ਕਰਦੇ ਆ ਇਹਨਾਂ 'ਚ ਟਾਈਮਰ ਲੱਗ ਜਾਂਦੇ ਹੈਗੇ ਇਹਨਾਂ 'ਚ ਟੈਂਪਰੇਚਰ ਸੈੱਟ ਆ ਜਾਂਦਾ ਅਤੇ ਜੋ ਕਿ ਪਹਿਲਾਂ ਪੋਸੀਬਲ ਨਹੀਂ ਹੈਗਾ ਸੀ ਤਾਂ ਹੁਣ ਇਹ ਨਵੇਂ ਨਵੇਂ ਆਪਣੇ ਤਰੀਕੇ ਆ ਰਹੇ ਹੈ ਭੋਜਨ ਨੂੰ ਖਾਣ ਦੇ ਹੋ ਗਏ ਬਣਾਉਣ ਦੇ ਹੋ ਗਏ ਤਾਂ ਬਹੁਤ ਵੱਡਾ ਯੋਗਦਾਨ ਹੈਗਾ